ਤਕਨੋਲਜੀ ਨੇ ਬੈਂਕਿੰਗ ਨੂੰ ਅ ਅੱਜ ਦੇ ਟ ਸਮੇਂ ਵਿੱਚ ਬਹੁਤ ਹੀ ਆਸਾਨ ਬਣਾ ਦਿੱਤਾ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਪਹਿਲਾਂ ਪਹਿਲਾਂ ਜਦੋਂ ਆਪਾਂ ਜਾਂਦੇ ਹੁੰਦੇ ਸੀ ਤਾਂ ਬੈਂਕਾਂ ਵਿੱਚ ਬਹੁਤ ਹੀ ਲੰਬੀਆਂ ਕਤਾਰਾਂ ਲੱਗਦੀਆਂ ਸੀਗੀਆਂ ਜਿਸ ਨਾਲ ਕਿ ਸਾਡਾ ਬਹੁਤ ਹੀ ਸਮਾਂ ਬਰਬਾਦ ਹੁੰਦਾ ਸੀ ਅਤੇ ਕਈ ਵਾਰ ਤਾਂ ਕੀ ਹੁੰਦਾ ਸੀ ਕਿ ਸਾਡੀ ਲਾਈਨ 'ਚ ਖੜਿਆਂ ਦੀ ਵਾਰੀ ਵੀ ਨਹੀਂ ਸੀ ਆਉਂਦੀ ਕਿ ਕਦੋਂ ਉਹਨਾਂ ਦਾ ਲੰਚ ਟਾਈਮ ਹੋ ਜਾਂਦਾ ਸੀ ਅਤੇ ਕਦੋਂ ਛੁੱਟੀ ਟਾਈਮ ਵੀ ਹੋ ਜਾਂਦਾ ਸੀ ਬਟ ਅੱਜ ਦੇ ਟਾਈਮ ਵਿੱਚ ਤਕਨੋਲਜੀ ਦੀ ਮਦਦ ਨਾਲ ਅਸੀਂ ਘਰ ਬੈਠੇ ਆਪਣੀਆਂ ਬੈਂਕ ਬੈਲੈਂਸ ਚੈੱਕ ਕਰ ਸਕਦੇ ਹਾਂ ਏ ਟੀ ਐੱਮ ਦੀ ਮਦਦ ਨਾਲ ਆਪਾਂ ਕਿਤੇ ਵੀ ਹੋਈਏ ਬਾਜ਼ਾਰ ਵਿੱਚ ਤਾਂ ਆਪਾਂ ਪੈਸੇ ਕਢਵਾ ਸਕਦੇ ਹਾਂ ਜਮ੍ਹਾਂ ਕਰਵਾ ਸਕਦੇ ਹਾਂ ਕਿਸੇ ਆਪਣੇ ਭਾਈਚਾਰੇ ਵਿੱਚ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਆਪਾਂ ਚੌਵੀ ਘੰਟੇ ਵ ਵਿੱਚ ਐਨੀ ਟਾਈਮ ਕਦੇ ਵੀ ਉਸਨੂੰ ਪੈਸੇ ਭੇਜ ਸਕਦੇ ਹਾਂ ਇਸ ਇਹ ਸਾਰਾ ਤੈਕਨੋਲਜੀ ਦੀ ਮਦਦ ਨਾਲ ਹੀ ਸੰਭਵ ਹੋਇਆ ਹੈ ਪ੍ਰੰਤੂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਅੱਜ ਟਾਈਮ ਵਿੱਚ ਜੋ ਵੀ ਸਭ ਕੁਛ ਔਨਲਾਈਨ ਹੈ ਇਹਦੇ ਬਹੁਤ ਨੁਕਸਾਨ ਵੀ ਹੋਏ ਨੇ ਇਸ ਨਾਲ ਕੀ ਆਪਾਂ ਨੂੰ ਕਈ ਵਾਰੀ ਫੇਸ ਕਰਨਾ ਪੈਂਦਾ ਹੈ ਕਿ ਆਪਣੇ ਕਈ ਵਾਰੀ ਫਰੋਡ ਦੇ ਸਿਸਟਮ ਦੇ ਹੋਣ ਦੇ ਨਾਲ ਨਾਲ ਲੋਕ ਕਈ ਵਾਰ ਲੋਕਾਂ ਨੂੰ ਬੇਵਕੂਫ ਬਣਾ ਜਾਂਦੇ ਨੇ ਕਿ ਜਿਵੇਂ ਕਿ ਤੁਹਾਡੇ ਨੰਬਰ 'ਤੇ ਕੋਈ ਓ ਟੀ ਪੀ ਆਉਂਦਾ ਤਾਂ ਤੁਸੀਂ ਦੱਸ ਦਿੰਦੇ ਹੋ ਕਿ ਬੈਂਕ ਵੱਲੋਂ ਮੰਗਿਆ ਗਿਆ ਹੋਊਗਾ ਬਟ ਇਹ ਇੱਕ ਜਦੋਂ ਵੀ ਕੋਈ ਫਰੋਡ ਇੱਦਾਂ ਦੀ ਹੁੰਦੀ ਹੈ ਤਾਂ ਬਾਅਦ ਵਿੱਚ ਪਤਾ ਲੱਗਦਾ ਕਿ ਮੇਰੇ ਇੰਨੇ ਪੈਸੇ ਨਿਕਲ ਗਏ ਹੈ ਕਿ ਜਿਸ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਇਹਦੇ ਨਾਲ ਨਾਲ ਤਕਨਲੋਜੀ ਨਾਲ ਫਾਇਦਿਆਂ ਦੇ ਨਾਲ ਨਾਲ ਕਈ ਅੱਜ ਕੱਲ੍ਹ ਨੁਕਸਾਨ ਵੀ ਹੋਏ ਨੇ